ਨਮਸਕਾਰ ਮੈਂ ਕੁਝ ਦਿਨ ਪਹਿਲਾਂ ਫਲਿਪਕਾਰਡ ਦੀ ਨਵੇਂ ਸਾਲ ਦੀ ਸੇਲ ਤੋਂ ਰੇਡਮੀ ਦਾ ਫੋਨ ਔਡਰ ਕੀਤਾ ਸੀ ਔਡਰ ਦੀ ਡੇਟ ਪੰਦਰ੍ਹਾਂ ਫਰਵਰੀ ਅਤੇ ਔਡਰ ਨੰਬਰ ਪੰਜ ਛੇ ਪੰਜ ਪੰਜ ਪੰਜ ਅੱਠ ਹੈ ਮੈਂ ਜਾਣਨਾ ਚਾਹੁੰਦੀ ਹਾਂ ਮੇਰੇ ਔਡਰ ਦੀ ਅਪਡੇਟ ਕੀ ਹੈ ਇਹ ਫੋਨ ਮੈਨੂੰ ਵੀਹ ਫਰਵਰੀ ਨੂੰ ਡਿਲਿਵਰ ਹੋਣਾ ਸੀ ਜੀ ਅਜੇ ਜੋ ਅਜੇ ਤੱਕ ਨਹੀਂ ਆਇਆ ਮੈਂ ਬੇਨਤੀ ਕਰਦੀ ਹਾਂ ਮੈਨੂੰ ਮੇਰੇ ਓਡਰ ਦਾ ਸਟੇਟਸ ਸਟੇਟਸ ਦੱਸਿਆ ਜਾਵੇ ਕਿਉਂਕਿ ਐਪਲੀਕੇਸ਼ਨ ਉੱਪਰ ਮੇਰੇ ਓਡਰ ਦਾ ਸਟੇਟਸ ਮੈਨੂੰ ਓਨ ਦੀ ਸਪੋ ਓਨ ਦੀ ਵੇਅ ਦੱਸ ਰਿਹਾ ਹੈ ਪੈਸੇ ਵੀ ਔਨਲਾਈਨ ਪੇ ਕਰ ਚੁੱਕੀ ਹਾਂ ਇਸ ਲਈ ਮੈਨੂੰ ਚਿੰਤਾ ਹੋ ਰਹੀ ਹੈ ਕਿ ਮੇਰੇ ਪੈਸੇ ਫਸ ਨਾ ਜਾਣ ਮੇਰੀ ਸਹਾਇਤਾ ਕੀਤੀ ਜਾਵੇ ਧੰਨਵਾਦ